ਹੈਲੋ ਆਹੂਜਾ ਟਰੈਵਲਸ ਤੋਂ ਹਾਂਜੀ ਹੁਣੇ ਮੈਂ ਤੁਹਾਡੀ ਗੱਡੀ 'ਚ ਟਰੈਵਲ ਕੀਤਾ ਚੰਡੀਗੜ੍ਹ ਟੂ ਪਟਿਆਲਾ ਤੁਸੀਂ ਮੈਨੂੰ ਬਡੁੰਗਰ ਰੋਡ ਉਤੇ ਛੱਡ ਕੇ ਗਏ ਹੋ ਅਤੇ ਮੈਂ ਉੱਤਰ ਕੇ ਵੇਖਿਆ ਕਿ ਮੇਰਾ ਬੈਗ ਮੇਰੇ ਕੋਲ ਨਹੀਂ ਹੈ ਉਹ ਸ਼ਾਇਦ ਤੁਹਾਡੀ ਗੱਡੀ 'ਚ ਹੀ ਰਹਿ ਗਿਆ ਉਹਦੇ ਵਿੱਚ ਮੇਰੇ ਬਹੁਤ ਜ਼ਰੂਰੀ ਡਾਕੂਮੈਂਟ ਨੇ ਵੋਟਰ ਕਾਰਡ ਆਈ ਡੀ ਕਾਰਡ ਏ ਟੀ ਐੱਮ ਵਗੈਰਾ ਉਹਦੇ 'ਚ ਮੇਰਾ ਪਿਆ ਪਲੀਜ਼ ਤੁਸੀਂ ਮੈਨੂੰ ਹੁਣੇ ਚੈੱਕ ਕਰਕੇ ਦੱਸੋ ਕਿ ਉਹ ਰਹਿ ਗਿਆ ਜਾਂ ਨਹੀਂ ਰਹਿ ਗਿਆ ਜਾਂ ਮੈਂ ਉੱਥੇ ਹੀ ਭੁੱਲੀ ਹਾਂ ਜਾਂ ਸ਼ਾਇਦ ਮੈਂ ਕਿਤੇ ਹੋਰ ਰੱਖਤਾ ਬੇਸਿਕਲੀ ਮੈਨੂੰ ਨਹੀਂ ਲੱਗਦਾ ਕਿ ਮੈਂ ਕਿਤੇ ਹੋਰ ਰੱਖਿਆ ਮੈਨੂੰ ਪੂਰਾ ਯਕੀਨ ਹੈ ਕਿ ਸ਼ਾਇਦ ਇਹ ਉੱਥੇ ਤੁਹਾਡੀ ਹੀ ਗੱਡੀ 'ਚ ਰਹਿ ਗਿਆ ਹੈ ਇਸ ਕਰਕੇ ਤੁਸੀਂ ਹੁਣੇ ਚੈੱਕ ਕਰੋ ਮੈਨੂੰ ਇਨਫੋਰਮ ਕਰੋ ਅਤੇ ਮੈਂ ਇੱਥੇ ਖੜ੍ਹੀ ਹਾਂ ਬਡੁੰਗਰ ਰੋਡ 'ਤੇ ਤੁਸੀਂ ਮੈਨੂੰ ਹੁਣੇ ਮੇਰਾ ਪਰਸ ਪਕੜਾ ਕੇ ਜਾਉ ਇਹ ਬਹੁਤ ਇੰਪੋਰਟੈਂਟ ਹੈ ਪਲੀਜ਼ ਜੇ ਤੁਸੀਂ ਇੱਦਾਂ ਨਹੀਂ ਕਰਦੇ ਤਾਂ ਮੈਂ ਤੁਹਾਡੀ ਕੰਪਲੇਂਟ ਕਰ ਦੇਵਾਂਗੀ ਪੁਲਿਸ ਨੂੰ